ਹੈਲੋ ਹਾਂਜੀ ਸਰ ਰੁਜ਼ਗਾਰ ਔਫਿਸਰ ਔਫਿਸ ਤੋਂ ਬੋਲਦੇ ਹੋ ਜੀ ਸਰ ਮੈਂ ਨਾ ਮੇਰੀ ਕੁਆਲੀਫੀਕੇਸ਼ਨ ਹੈ ਪਲੱਸ ਟੂ ਪਲੱਸ ਡਿਪਲੋਮਾ ਕੋਈ ਆਪ ਦੇ ਕੋਲ ਜੋਬ ਹੋਵੇ ਜੀ ਪਾਰਟ ਟਾਈਮ ਹੋਵੇ ਫੁੱਲ ਡੇਅ ਹੋਵੇ ਜੀ ਦੋ ਸਾਲ ਪਹਿਲਾਂ ਦੋ ਹਜ਼ਾਰ ਇੱਕੀ ਇੱਕ ਇੱਕ ਇੱਕ ਸਾਲ ਦਾ ਕੰਪਿਊਟਰ ਡਿਪਲੋਮਾ ਨਹੀਂ ਜੀ ਜੋਬ ਤਾਂ ਨਹੀਂ ਫਿਲਹਾਲ ਫਰੀ ਹਾਂ ਜੀ ਜੀ ਐਡਰੈੱਸ ਵੀ ਪੀ ਓ ਪਮੋਹਤ ਤਹਿਸੀਲ ਬੱਸੀ ਪਠਾਣਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਜੀ ਜੀ ਜੀ ਜੀ ਬਿਲਕੁਲ ਜੀ ਕੰਪਿਊਟਰ ਦੇ ਕੰਪਿਊਟਰ ਦੇ ਰਿਲੇਟਿਡ ਕੋਈ ਵੀ ਕੰਮ ਹੋਵੇ ਜੀ ਹਾਂਜੀ ਜੋਬ ਕਿੱਥੇ ਹੈ ਜੀ ਡਾਟਾ ਐਂਟਰੀ ਦੀ ਪਾਰਟ ਟਾਈਮ ਜਾਂ ਫੁੱਲ ਡੇਅ ਜੀ ਅੱਛਾ ਜੀ ਕੰਪਨੀ ਕੰਪਨੀ ਵਧੀਆ ਹੋਵੇ ਤਾਂ ਚੱਲਜੂ ਕੋਈ ਗੱਲ ਨਹੀਂ ਸਰ ਦੇਖੋ ਹੁਣ ਘੱਟੋ ਘੱਟ ਜਿਵੇਂ ਪ੍ਰਾਈਵੇਟ ਦਾ ਹੈ ਵੀਹ ਪੱਚੀ ਹਜ਼ਾਰ ਤਾਂ ਹੋਣੀ ਚਾਹੀਦੀ ਹੈ ਜੀ ਜੀ ਜੀ ਰਿਜ਼ਿਊਮ ਤੁਹਾਨੂੰ ਰਿਜ਼ਿਊਮ ਤੁਹਾਨੂੰ ਵਟਸਐਪ ਭੇਜੀਏ ਜਾਂ ਦੇ ਕੇ ਜਾਈਏ ਜੀ ਦੇਖ ਲਉ ਜੇਕਰ ਕੋਈ ਗੋਰਵਮੈਂਟ ਸੈਕਟਰ 'ਚ ਮਿਲਦੀ ਹੈ ਜੀ ਪ੍ਰਾਈਵੇਟ ਤਾਂ ਪ੍ਰਾਈਵੇਟ ਹੀ ਹੁੰਦਾ

ਠੀਕ ਹੈ ਜੀ ਠੀਕ ਹੈ ਓਕੇ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ